ਅੱਜ ਦਾ ਪੂਰਾ ਹੀ ਯੁੱਗ ਦਿਨੋਂ ਦਿਨ ਵਿਕਸਿਤ ਹੋ ਰਿਹਾ ਹੈ ਪੂਰੇ ਸੰਸਾਰ ਦੇ ਵਿਕਾਸ ਕਾਰਨ ਪੁ ਆਪਸੀ ਦੇਸ਼ਾਂ ਦੇ ਵਿੱਚ ਤਾਲਮੇਲ ਦਿਨੋਂ ਦਿਨ ਵੱਧ ਰਹੇ ਹਨ ਜੇਕਰ ਅਸੀਂ ਨ ਨਵੀਆਂ ਕਾਢਾਂ ਦੀ ਗੱਲ ਕਰੀਏ ਤਾਂ ਨਵੀਆਂ ਕਾਢਾਂ ਨੇ ਮਨੁੱਖ ਦਾ ਜੀਵਨ ਜਿਉਣਾ ਹੋਰ ਵੀ ਸੌਖਾ ਕਰ ਦਿੱਤਾ ਹੈ ਜਿੱਥੇ ਮਨੁੱਖ ਪਹਿਲਾਂ ਕਿਤੇ ਜਾਣ ਨੂੰ ਇੱਕ ਦਿਨ ਦੋ ਦਿਨ ਲਗਾਇਆ ਕਰਦਾ ਸੀ ਹੁਣ ਉਹ ਕੁੱਝ ਹੀ ਘੰਟਿਆਂ ਵਿੱਚ ਜਾਂ ਅੱਧੇ ਦਿਨ ਦੇ ਵਿੱਚ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦਾ ਹੈ ਜੋ ਕੰਮ ਮਨੁੱਖ ਪਹਿਲਾਂ ਘੰਟੇ ਦੋ ਘੰਟੇ ਲਗਾ ਕੇ ਕਰਿਆ ਕਰਦਾ ਸੀ ਹੁਣ ਉਹੀ ਮਨੁੱਖ ਉਸ ਕੰਮ ਨੂੰ ਅੱਧਾ ਘੰਟਾ ਜਾਂ ਪੰਦਰਾਂ ਮਿੰਟਾਂ ਵਿੱਚ ਕਰ ਲੈਂਦਾ ਹੈ